ਮੇਰਾ ਮਨਪਸੰਦ ਘੁੰਮਣ ਲਈ ਪਹਾੜੀ ਇਲਾਕਾ ਹੈ ਪਹਾੜੀ ਇਲਾਕਿਆਂ ਵਿੱਚ ਹਾਈਕ ਕਰਨ ਲਈ ਬਹੁਤ ਚੁਨੌਤੀਆਂ ਆਉਂਦੀਆਂ ਹਨ ਜੋ ਕਿ ਮੈਨੂੰ ਬਹੁਤ ਪਸੰਦ ਹੈ ਉਹਨਾਂ ਚੁਣੌਤੀਆਂ ਨੂੰ ਪੂਰਾ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ